ਹਾਂ ਮੇਰਾ ਫੇਵਰਟ ਸਿੰਗਰ ਤਰਸੇਮ ਜੱਸੜ ਹੈ ਕਿਉਂਕਿ ਮੈਨੂੰ ਉਹਨਾਂ ਦੇ ਗਾਣੇ ਸੁਣਨੇ ਬਹੁਤ ਜ਼ਿਆਦਾ ਪਸੰਦ ਹੈਗੇ ਆ ਅਤੇ ਉਹਉਹ ਕਿਉਂ ਉਹ ਮੈਨੂੰ ਤਾਂ ਇਸ ਲਈ ਪਸੰਦ ਹੈ ਕਿਉਂਕਿ ਉਹ ਬਹੁਤ ਹੀ ਵਧੀਆ ਪੱਗ ਬੰਨਦੇ ਹਨ ਉਹਨਾਂ ਦਾ ਪੱਗ ਬੰਨਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਉਹਨਾਂ ਦੇ ਕੱਪੜੇ ਪਾਉਣ ਦਾ ਮਤਲਬ ਤਰੀਕਾ ਵੀ ਬਹੁਤ ਵਧੀਆ ਹੁੰਦਾ ਹੈ ਉਹਨਾਂ ਦੀ ਪਰਸਨੈਲਿਟੀ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਉਹਨਾਂ ਦਾ ਡਰੈਸਿੰਗ ਸੈਂਸ ਵੀ ਬਹੁਤ ਵਧੀਆ ਹੁੰਦਾ ਹੈ ਅਤੇ ਉਹ ਬਹੁਤ ਹੀ ਵਧੀਆ ਗਾਣੇ ਗਾਉਂਦੇ ਹਨ ਨਾ ਹੀ ਉਹ ਗੰਦੇ ਹੁੰਦੇ ਹਨ ਅਤੇ ਨਾ ਬਹੁਤ ਹੀ ਵਧੀਆ ਗਾਣੇ ਹੁੰਦੇ ਹਨ ਜੋ ਕਿ ਸਭ ਦੇ ਸੁਣਨ ਵਾਲੇ ਹੁੰਦੇ ਹਨ ਉਹਨਾਂ ਦੇ ਗਾਣੇ ਕੋਈ ਵੀ ਸੁਣ ਸਕਦਾ ਬੱਚੇ ਬਜ਼ੁਰਗ ਜੋ ਨੌਜਵਾਨ ਕੋਈ ਵੀ ਸੁਣ ਸਕਦਾ ਬਹੁਤ ਹੀ ਵਧੀਆ ਗਾਣੇ ਹੁੰਦੇ ਹਨ ਇਸ ਲਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਹਨ ਅਤੇ ਉਹ ਮੇਰੇ ਪਸੰਦੀਦਾ ਸਿੰਗਰ ਹੈਗੇ ਹੈਗੇ ਅਤੇ ਜਦੋਂ ਵੀ ਉਹਨਾਂ ਨੂੰ ਕੋਈ ਲੋਕ ਜਾ ਕੇ ਮਿਲਦੇ ਹਨ ਜਾਂ ਉਹਨਾਂ ਦੇ ਫੈਨ 'ਚ ਉਹਨਾਂ ਨੂੰ ਜਾਣ ਮਿਲਦੇ ਹਨ ਤਾਂ ਉਹ ਵਧੀਆ ਤਰੀਕੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਹਨਾਂ ਨੂੰ ਨੋਰਮਲੀ ਮਿਲਦੇ ਹਨ ਉਹ ਬਹੁਤ ਇੱਦਾਂ ਮਾਣ ਮਹਿਸੂਸ ਨਹੀਂ ਕਰਦੇ ਕਿ ਉਹ ਬਹੁਤ ਵੱਡੇ ਸਿੰਗਰ ਹਨ ਹਰ ਇੱਕ ਨੂੰ ਹੱਸ ਕੇ ਬੁਲਾਉਂਦੇ ਨੇ ਇਸ ਲਈ ਮੈਨੂੰ ਬਹੁਤ ਵਧੀਆ ਲੱਗਦੇ ਹਨ